ਇਹ ਪ੍ਰਸ਼ਨ ਕੁੱਛ ਇਸ ਪ੍ਰਕਾਰ ਹੈ ਤੁਸੀਂ ਆਪਣੇ ਇਲਾਕੇ ਦੀ ਕਿਹੜੀਆਂ ਸਿਆਸੀਆਂ ਪਾਰਟੀਆਂ ਅਤੇ ਨੇਤਾਵਾਂ ਨੂੰ ਜਾਣਦੇ ਹੋ ਸਾਡੇ ਇਲਾਕਾ ਵਿੱਚ ਕਾਫ਼ੀ ਸਿਆਸੀ ਨੇਤਾ ਅਤੇ ਉਨ੍ਹਾਂ ਦੀ ਪਾਰਟੀਆਂ ਦੇ ਪ੍ਰਬੰਧਕ ਕਾਫ਼ੀ ਆਉਂਦੇ ਆ ਅਤੇ ਉਹ ਸਾਡੇ ਨਾਲ ਕਾਫ਼ੀ ਵਾਅਦੇ ਕਰਦੇ ਆ ਕਿ ਅਸੀਂ ਤੁਹਾਡੇ ਲਈ ਪਾਰਕ ਬਣਾਵਾਂਗੇ ਅਤੇ ਪਾਣੀ ਦੀ ਕਦੇ ਤੁਹਾਨੂੰ ਦਿੱਕਤ ਨਹੀਂ ਹੋਊਗੀ ਸੜਕਾਂ ਬਣਾਵਾਂਗੇ ਰੋਡ ਬਣਾਵਾਂਗੇ ਅਤੇ ਕਾਫ਼ੀ ਵਾਅਦੇ ਵੀ ਕਰਦੇ ਆ ਕਿ ਸਕੀਮਾਂ ਵੀ ਲਾਂਚ ਕਰਦੇ ਆ ਕਿ ਮਿਊਂਸੀਪਲ ਕਾਰਪੋਰੇਸ਼ਨ ਵਾਲੇ ਆਉਂਦੇ ਆ ਕਿ ਸਫਾਈ ਹੋਊਗੀ ਕੂੜਾ ਲੈਣ ਆਉਗੇ ਮੁਫ਼ਤ ਵਿੱਚ ਅਤੇ ਉਹ ਕਹਿੰਦੇ ਹੈ ਕਿ ਪਲਾਸਟਿਕ ਅਤੇ ਅਲਗ ਅਲਗ ਕਚਰੇ ਦੀ ਅਲਗ ਅਲਗ ਡੱਬਾ ਹੋਊਗਾ ਏਕ ਮਿੰਟ ਮੁਝੇ ਖਾਂਸੀ ਆ ਰਹੀ ਹੈ ਹਾਂ ਤੋ ਵੋਹ ਤੋ ਕਾਫ਼ੀ ਵਾਅਦੇ ਕਰਦੇ ਉਹ ਕਾਫ਼ੀ ਕੁਝ ਚੀਜ਼ਾਂ ਕਰਦੇ ਹੈ ਲੇਕਿਨ ਉਹਨਾਂ ਵਿੱਚ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਜੋ ਆਪਣੇ ਵਾਅਦਿਆਂ 'ਤੇ ਅਮਲ ਕਰਦੇ ਆ ਜਿਵੇਂ ਸਾਡੇ ਇਲਾਕੇ ਵਿੱਚ ਮੈਂ ਇੱਕ ਨੇਤਾ ਦਾ ਨਾਮ ਨਹੀਂ ਲੈ ਸਕਦਾ ਉਹ ਗਲਤ ਹੋ ਜਾਊਗਾ ਜਿਹੜੀ ਸਾਡੇ ਇਲਾਕੇ ਵਿੱਚ ਇੱਕ ਐਕਸ ਨੇਤਾ ਹੈ ਉਹ ਆਏ ਅਤੇ ਉਹਨਾਂ ਨੇ ਸਾਨੂੰ ਵਾਅਦੇ ਕੀਤੇ ਕਿ ਅਸੀਂ ਪਾਰਕ ਬਣਾਵਾਂਗੇ ਉਹ ਬਣਾ ਉਹਨਾਂ ਨੇ ਬਣਾ ਦਿੱਤਾ ਵਧੀਆ ਗੱਲ ਹੈ ਬਣਾ ਦਿੱਤਾ ਅਤੇ ਜਿੱਤ ਗਏ ਹਾਂ ਵਧੀਆ ਗੱਲ ਹੋ ਗਈ ਅੱਗੇ ਫਿਰ ਦੱਸਦਾਂ ਇਹੋ ਜਿਹੇ ਕਈ ਨੇਤਾ ਆਉਂਦੇ ਹੈ ਲੇਕਿਨ ਕਈ ਨੇ ਤਾਂ ਇਹੋ ਜਿਹੇ ਜਿਹੜੇ ਕਰਪਟ ਵੀ ਹੁੰਦੇ ਜਿਵੇਂ ਸਮਝੋ ਮੈਂ ਇੱਕ ਤੁਹਾਨੂੰ ਇਗਜਾਮਪਲ ਦਿੰਦਾ ਜਿਵੇਂ ਮੰਮੀ ਨੇ ਮੈਨੂੰ ਪੈਸੇ ਦਿੱਤੇ ਹੈ ਕਿ ਕਰਿਆਨੇ ਦੀ ਦੁਕਾਨ ਤੋਂ ਸਮਾਨ ਲਿਆਓ ਅਤੇ ਉਹਦੇ 'ਚ ਪੰਜ ਰੁਪਏ ਬਚ ਜਾਂਦੇ ਆ ਤਾਂ ਦੁਕਾਨਦਾਰ ਕੀ ਕਰਦਾ ਉਹ ਪੰਜ ਟੋਫੀਆਂ ਦੇ ਦਿੰਦਾ ਹੈ ਅਤੇ ਉਹ ਆਪਣਾ ਮੁਨਾਫ਼ਾ ਸੋਚਦਾ ਉਸ ਚੀਜ਼ 'ਚ ਇਹੋ ਜਿਹੀ ਹੁੰਦੀ ਸਰਕਾਰ ਸਰਕਾਰ ਕੀ ਕਰਦੀ ਹੈ ਸਰਕਾਰ ਨੂੰ ਜਿੰਨਾ ਪੈਸਾ ਅਲੋਟ ਹੁੰਦਾ ਹੈ ਉਹ ਮੰਤਰੀਆਂ 'ਚ ਵੰਡ ਦਿੰਦੇ ਆ ਮੰਤਰੀਆਂ 'ਚ ਵੰਡਣ ਤੋਂ ਬਾਅਦ ਜਿਹੜਾ ਪੈਸਾ ਬਾਅਦ 'ਚ ਬਹੁਤ ਘੱਟ ਪੈਸਾ ਕੰਮ ਸੜਕਾਂ ਦੇ ਕੰਮ ਵਾਸਤੇ ਮਿਲਦਾ ਹੈ ਤਾਂ ਮਤਲਬ ਮਤਲਬ ਬਹੁਤ ਸਾਨੂੰ ਮੁਸੀਬਤਾਂ ਦਾ ਸਾਹਮਣੇ ਵੀ ਕਰਨਾ ਪੈ ਜਾਂਦਾ ਇਸ ਸਥਿਤੀ 'ਚ ਅਤੇ ਸਾਡੇ ਇਲਾਕੇ ਜਿਵੇਂ ਬਾਹਰੋਂ ਬੰਦੇ ਆਉਂਦੇ ਹੈ ਯੂ ਪੀ ਬਿਹਾਰ ਰਾਜਸਥਾਨ ਅਤੇ ਮਤਲਬ ਕਾਫ਼ੀ ਸਮੱਸਿਆਵਾਂ ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆਪਣੇ ਦੇਸ਼ ਦੇ ਨੇਤਾਵਾਂ ਦਾ ਮੰਤਰੀਆਂ ਦਾ ਸੰਤਰੀਆਂ ਦਾ ਅਤੇ ਬਹੁਤ ਬਹੁਤ ਧੰਨਵਾਦ